ਮੇਰਾ ਨਾਮ ਭਾਰਤ ਭੂਸ਼ਨ ਪਿੰਡ ਮਿਰਜਾਪੁਰ ਜ਼ਿਲਾ ਪਠਾਨਕੋਟ ਦਾ ਰਹਿਣ ਵਾਲਾ ਅਤੇ ਜੇ ਗਲ ਕਰੀਏ ਤਕਨੀਕੀ ਬਦਲਾਅ ਦੇ ਕਾਰਨ ਬਦਲਾਅ ਦੇ ਵਿਚ ਦੇਖਿਆ ਗਿਆ ਭਾਰਤ ਵਿੱਚ ਸਭ ਤੋਂ ਟੋਪ 'ਤੇ ਆਉਂਦੇ ਆ ਮੁਕੇਸ਼ ਅੰਬਾਨੀ ਜੀ ਜਿਹਨਾਂ ਨੇ ਰਿਲਾਇੰਸ ਜੀਓ ਦੇ ਨਾਮ 'ਤੇ ਆਪਣੀ ਕੰਪਨੀ ਖੋਲ੍ਹੀ ਹੋਈ ਆ ਇਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਬਦਲਾਅ ਕੀਤਾ ਜਿੱਦਾਂ ਪਹਿਲਾਂ ਨੈਟਵਰਕਿੰਗ ਦੇ ਵਿੱਚ ਬਦਲਾਅ ਕੀਤਾ ਪਹਿਲਾਂ ਜਦੋਂ ਆਪਾਂ ਕੋਲਿੰਗ ਕਰਦੇ ਸੀ ਇਹ ਕਾਫੀ ਹੱਦ ਤੱਕ ਮਹਿੰਗਾ ਵੀ ਪੈਂਦਾ ਸੀ ਕੋਸਟਲੀ ਨੈਟ ਵਗੈਰਾ ਵੀ ਚਲਾਉਣਾ ਹੁੰਦਾ ਸੀ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਸੀ ਇਹਨਾਂ ਨੇ ਭ ਭਾਰਤ ਦੇ ਵਿੱਚ ਆਪਣੀ ਜੀਓ ਕੰਪਨੀ ਲਿਆ ਕੇ ਇੱਕ ਤਾਂ ਕੋਲਿੰਗ ਰੇਟ ਘਟਾਏ ਦੂਜਾ ਨੈਟ ਕਾਫੀ ਹੱਦ ਤੱਕ ਫਰੀ ਕਰ ਦਿੱਤਾ ਬਹੁਤ ਵਧੀਆ ਲੱਗਦਾ ਆ ਅਤੇ ਨਾਲ ਦੀ ਨਾਲ ਇਹਨਾਂ ਨੇ ਆਪਣੇ ਸੀ ਐਨ ਜੀ ਇਹ ਪੈਟਰੋਲ ਪੰਪ ਉਦਯੋਗ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਕਿ ਆਪਣੇ ਮੁਕੇਸ਼ ਅੰਬਾਨੀ ਜੀ ਦੀਆਂ ਹੀ ਆ ਰਹੀਆਂ ਨੇ ਜੀਓ ਕੰਪਨੀ ਦੇ ਨਾਮ 'ਤੇ ਇਹ ਕਾਫੀ ਜ਼ਿਆਦਾ ਲੋਂਚ ਹੋਈਆਂ ਬਹੁਤ ਵਧੀਆ ਲੱਗਦਾ ਮੁਕੇਸ਼ ਅੰਬਾਨੀ ਜੀ ਇਹ ਭਾਰਤ ਦੇ ਬਹੁਤ ਵਧੀਆ ਬੰਦੇ ਹਨ ਜਿਹਨਾਂ ਨੇ ਇਹ ਕੰਪਨੀਆਂ ਸ਼ੁਰੂ ਕਰਕੇ ਭਾਰਤ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਅਤੇ ਮੈਂ ਚਾਹੁੰਦਾ ਕਿ ਹਰ ਕੋਈ ਇਹਨਾਂ ਵਰਗਾ ਬਣ ਕੇ ਅਤੇ ਇਹਨਾਂ ਦੀ ਸੇਧ 'ਤੇ ਚੱਲੇ ਇਹ ਪਹਿਲਾਂ ਬਹੁਤ ਜ਼ਿਆਦਾ ਗਰੀਬ ਹੁੰਦੇ ਸੀ ਇਹ ਆਪਣੀ ਕੰਪਨੀ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਗਰੀਬ ਹੋਣ ਦੇ ਨਾਲ ਨਾਲ ਇਹਨਾਂ ਦਾ ਇੱਕ ਸੌਂਕ ਸੀ ਕਿ ਕਾ ਸਾਰਿਆਂ ਤੋਂ ਮਹਿੰਗੀ ਚਾਹ ਪੀਣੀ ਜਿੱਥੇ ਕੋਈ ਜ਼ਿਆਦਾ ਵੱਡੇ ਵਪਾਰੀ ਬੈਠੇ ਹੋਣ ਉਹਨਾਂ ਲਾਗੇ ਬਹਿ ਕੇ ਇਹ ਚਾਹ ਪੀਂਦੇ ਸੀ ਅਤੇ ਉਹਨਾਂ ਦੀਆਂ ਗੱਲਬਾਤਾਂ ਸੁਣਦੇ ਸੀ ਉਹ ਕੀ ਕਹਿੰਦੇ ਹੈ ਕੀ ਕਰਨਾ ਚਾਹੁੰਦੇ ਹੈ ਉਹਨਾਂ ਦੇ ਮਕਸਦ ਕੀ ਆ ਅੱਗੇ ਜਾਣ ਦਾ ਇਹੋ ਜਿਹੀਆਂ ਚੀਜ਼ਾਂ ਨੋਟ ਕਰਦੇ ਕਰਦੇ ਕਰਦੇ ਉਹਨਾਂ ਨੇ ਆਪਣੀ ਕੰਪਨੀ ਖੋਲ੍ਹੀ ਕੰਪਨੀ ਦਾ ਨਾਮ ਜੀਓ ਰੱਖਿਆ ਬਹੁਤ ਵਧੀਆ ਵਰਕ ਕਰ ਰਹੀ ਆ ਅਤੇ ਇੱਦਾਂ ਹੀ ਬਹੁਤ ਵਧੀਆ ਨੈਟਵਰਕਿੰਗ ਸਿਸਟਮ ਦਿੱਤਾ ਹੁਣ ਤਾਂ ਫਾਈਵ ਜੀ ਵੀ ਇਹਨਾਂ ਨੇ ਲੌਂਚ ਕਰ ਤਾ ਫਾਈਵ ਜੀ ਦੇ ਵਿੱਚ ਤਾਂ ਇਹਨਾਂ ਨੇ ਅਨਲਿਮਿਟਡ ਡਾਟਾ ਅਨਲਿਮਿਟਡ ਕੋਲਿੰਗ ਜਿਹੜਾ ਪਹਿਲਾਂ ਅਸੀਂ ਰਿਚਾਰਜ ਦੋ ਸੌ ਉਨਤਾਲੀ ਰੁਪਏ ਦਾ ਕਰਾਉਂਦੇ ਉਹਦੇ ਵਿੱਚ ਹੀ ਸਭ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ